ਮੇਰੇ ਦੁਆਰਾ ਚੁਣਿਆ ਗਿਆ ਨੈਗਟਿਵ ਪ੍ਰੋਡਕਟ ਏਅਰ ਕੰਡੀਸ਼ਨਰ ਹੈ ਜਿਸ ਨੂੰ ਅਸੀਂ ਏ ਸੀ ਵੀ ਕਹਿ ਦਿੰਦੇ ਹਾਂ ਅੱਜ ਦੇ ਮਾਡਰਨ ਯੁਗ ਵਿੱਚ ਹਰ ਇਨਸਾਨ ਇੱਕ ਦੂਜੇ ਦੀ ਰੀਸ ਨਾਲ ਆਪਣੇ ਘਰਾਂ ਵਿੱਚ ਏ ਸੀ ਲਗਵਾ ਰਿਹਾ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਇਸ ਦੇ ਉਸਦੇ ਸਰੀਰ ਉੱਤੇ ਕਿੰਨੇ ਬੁਰੇ ਪ੍ਰਭਾਵ ਪੈ ਰਹੇ ਹਨ ਇਨਸਾਨ ਦੀ ਜ਼ਿੰਦਗੀ ਵਿੱਚ ਜਿੰਨੀਆਂ ਸਹੂਲਤਾਂ ਵੱਧ ਰਹੀਆਂ ਹਨ ਉੰਨੀਆਂ ਹੀ ਉਸ ਨੂੰ ਬਿਮਾਰੀਆਂ ਜਕੜ ਰਹੀਆਂ ਹਨ ਏ ਸੀ ਬਾਰੇ ਜੇਕਰ ਮੈਂ ਆਪਣੇ ਨਿੱਜੀ ਅਨੁਭਵ ਸਾਂਝੇ ਕਰਾਂ ਤਾਂ ਉਹ ਕੁਝ ਇਸ ਤਰ੍ਹਾਂ ਹਨ ਮੈਂ ਇੱਕ ਪੇਂਡੂ ਜੀਵਨ ਨਾਲ ਸਬੰਧ ਰੱਖਦੀ ਹਾਂ ਜਿੱਥੇ ਇਹਨਾਂ ਏ ਸੀ ਵਰਗੀਆਂ ਵਿਅਰਥ ਚੀਜ਼ਾਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ ਜਾਂਦੀ ਪਰ ਮੇਰੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਏ ਸੀ ਲੱਗੇ ਹੋਣ ਕਰਕੇ ਮੇਰਾ ਬਹੁਤਾ ਸਮਾਂ ਇੱਥੇ ਬਤੀਤ ਹੋਣ ਲੱਗਿਆ ਜਿਸ ਦਾ ਮੇਰੇ ਸਰੀਰ ਉੱਤੇ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਏ ਸੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਮੈਂ ਪੂਰੀ ਗਰਮੀ ਵਿੱਚ ਵੀ ਅਸਾਨੀ ਨਾਲ ਕੰਮ ਕਰ ਸਕਦੀ ਸੀ ਪਰ ਹੁਣ ਏ ਸੀ ਦੇ ਪ੍ਰਭਾਵ ਕਰਕੇ ਮੈਂ ਥੋੜ੍ਹੀ ਜਿਹੀ ਧੁੱਪ ਵਿੱਚ ਜਾ ਕੇ ਹੀ ਸਿਰ ਦਰਦ ਬੁਖਾਰ ਵਰਗੀਆਂ ਸਮੱਸਿਆਵਾਂ ਵਿੱਚ ਘਿਰ ਜਾਂਦੀ ਹਾਂ ਇਸ ਕਰਕੇ ਏ ਸੀ ਲਗਵਾਉਣ ਦੀ ਬਜਾਏ ਵੱਧ ਤੋਂ ਵੱਧ ਦਰਖੱਤ ਲਗਾਉਣੇ ਚਾਹੀਦੇ ਹਨ